ਸਾਡੇ ਦੋਸਤਾਂ ਅਤੇ ਪਰਿਵਾਰ ਦੇ ਵਿੱਚ ਕੋਈ ਵੀ ਜੇਕਰ ਕੋਈ ਖੇਡ ਸਿਖਲਾਈ ਲੈਣਾ ਚਾਹੁੰਦਾ ਤਾਂ ਮੈਂ ਉਹਨਾਂ ਨੂੰ ਗਾਈਡ ਕਰੂੰ ਕਿਉਂਕਿ ਪਹਿਲਾਂ ਸਾਡੇ ਸਕੂਲ ਦੇ ਵਿੱਚ ਕੋਚ ਹੁੰਦੇ ਸੀ ਜਿਸ ਅਤੇ ਜਿਸ ਤੋਂ ਮੈਂ ਵੀ ਸਿੱਖੀ ਹੈਗੀ ਜਿਹੜੇ ਕਿ ਮੈਂ ਬਹੁਤ ਖੇਡਾਂ ਦੇ ਵਿੱਚ ਭਾਗ ਵੀ ਲਿੱਤਾ ਜਿਵੇਂ ਕਿ ਹਾਕੀ ਫੁੱਟਬਾਲ ਜੀ ਉਹਦੇ ਵਿੱਚ ਅਸੀਂ ਮੈਚ ਦੇ ਵਿੱਚ ਵਧੀਆ ਰਹੇ ਹਾਂ ਗੇ ਉਹਨਾਂ ਨੇ ਸਾਨੂੰ ਇਸ ਤਰੀਕੇ ਨਾਲ ਵਧੀਆ ਗਾਈਡ ਕੀਤਾ ਗਾ ਜਿਸ ਨਾਲ ਅਸੀਂ ਹੋਰ ਵੀ ਦੂਜਿਆਂ ਨੂੰ ਗਾਈਡ ਕਰਦੇ ਹਾਂ ਅਤੇ ਆਪ ਵੀ ਖੇਡਾਂ ਦੇ ਵਿੱਚ ਪੂਰੇ ਐਕਸਪਰਟ ਹੋ ਜਾਂਦੇ ਹਾਂ ਅਤੇ ਜੇਕਰ ਮੈਂ ਅ ਇ ਜੇਕਰ ਉਹ

ਕੋਈ ਵੀ ਖੇਡ ਦੇ ਵਿੱਚ ਸਿਖਲਾਈ ਲੈਣਾ ਚਾਹੁੰਦੇ ਨੇ ਤਾਂ ਫਿਰ ਮੈਂ ਉਹਨਾਂ ਨੂੰ ਇਹ ਗਾਈਡ ਕਰੂੰਗੀ ਕਿ ਉਹ ਸਾਡੇ ਜਿਹੜੇ ਸਕੂਲ 'ਚ ਕੋਚ ਨੇ ਗੇ ਉਹਨਾਂ ਤੋਂ ਹੀ ਅ ਸਿਖਲਾਈ ਲੈਣ ਉਹੀ ਉਹ ਉਹ ਵਧੀ ਉਹ ਉਹਨਾਂ ਨੂੰ ਵਧੀਆ ਕਰਾ ਦੇਣਗੇ ਜਿਸ ਤਰੀਕੇ ਨਾਲ ਮੈਂ ਵੀ ਵਧੀਆ ਖੇਡ ਚੁੱਕੀ ਸੀਗੀ ਅਤੇ ਉਹ ਵੀ ਵਧੀਆ ਖੇਡ ਲੈਣਗੇ ਇਸ ਤਰ੍ਹਾਂ ਉਹ ਉ ਕੋਚ ਤੋਂ ਸਿਖਲਾਈ ਲੈਣਗੇ